ਇੱਕ ਸੈਲਾਨੀ ਨੂੰ ਮੇਰੇ ਸਥਾਨ ਵਿਚ ਜਾਂ ਨੇੜੇ ਤੇੜੇ ਦੇ ਕੁਝ ਸੈਰ ਸਪਾਟੇ ਦੇ ਸਥਾਨਾਂ ਦਾ ਦੌਰਾ ਕਰਨ ਲਈ ਬਹੁਤ ਘੱਟ ਹੀ ਖਰਚਣਾ ਪੈਂਦਾ ਹੈ ਮੇਰੇ ਸਥਾਨ ਦਾ ਦੌਰਾ ਕਰਨ ਲਈ ਤਕਰੀਬਨ ਤਿੰਨ ਤੋਂ ਚਾਰ ਹਜ਼ਾਰ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ ਜਿਸ ਦੇ ਵਿੱਚ ਨੇੜੇ ਤੇੜੇ ਦੇ ਸਾਰੇ ਦੌਰਾ ਕਰਨ ਵਾਲੇ ਸਥਾਨ ਸ਼ਾਮਿਲ ਹਨ ਅਤੇ ਨਾਲ ਹੀ ਦਿਨ ਦਾ ਖਾਣਾ ਪੀਣਾ ਅਤੇ ਪੈਟਰੋਲ ਦਾ ਖਰਚਾ ਵੀ ਸ਼ਾਮਿਲ ਹੈ ਕਹਿਣ ਦਾ ਭਾਵ ਇਹ ਹੈ ਕਿ ਮੇਰੇ ਸਥਾਨ ਦੇ ਵਿੱਚ ਘੁੰਮਣਾ ਬਹੁਤ ਹੀ ਘੱਟ ਖਰਚੇ ਵਾਲਾ ਕੰਮ ਹੈ